ਹਾਂਜੀ ਅਸੀਂ ਮਹਿਸੂਸ ਕਰਦੇ ਹਾਂ ਕਿ ਔਰਤਾਂ ਨੂੰ ਮਾਰਸ਼ਲ ਆਰਟ ਸਿੱਖਣ ਦੀ ਜ਼ਰੂਰਤ ਹੈ ਕਿਉਂਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਗੁੰਡਾਗਰਦੀ ਅਤੇ ਚੋਰੀਆਂ ਚਕਾਰੀਆਂ ਦਾ ਮਾਹੌਲ ਫੈਲ ਰਿਹਾ ਹੈ ਜੇ ਘਰ ਵਿੱਚ ਇਕੱਲੀ ਔਰਤ ਹੈ ਜੇ ਉਹਨੂੰ ਆਪ ਆਪਦੀ ਸੁਰੱਖਿਆ ਦੀ ਲੋੜ ਹੈਗੀ ਹੈ ਉਹਨੂੰ ਕਿਸੇ ਦੇ ਮੂੰਹ ਮੰਨੇ ਨਾ ਝਾਕਣਾ ਪਵੇ ਉਹ ਆਪਦੀ ਆਪ ਸੁਰੱਖਿਆ ਕਰ ਸਕੇ ਜੇ ਕੋਈ ਉ ਉਹਨੂੰ ਐਜ਼ਾ ਲੱਗੇ ਤਾਂ ਕਿ ਆਪਦੀ ਸੇਫਟੀ ਵਾਸਤੇ ਉਹ ਆਪਦੀ ਸੁਰੱਖਿਆ ਵਾਸਤੇ ਉਹਨੂੰ ਮਾਰਸ਼ਲ ਆਰਟ ਸਿੱਖਣ ਦੀ ਜ਼ਰੂਰਤ ਹੈ ਕ ਕਰਾਟੇ ਸਿੱਖਣ ਦੀ ਲੋੜ ਹੈਗੀ ਹੈ ਤਾਂ ਕਿ ਜੇ ਉਹਨੂੰ ਆਮ ਕਰਾਟੇ ਆਉਂਦੇ ਹੋਣ ਤਾਂ ਉਹ ਮ ਆਪ ਦੀ ਸੁਰੱਖਿਆ ਆਪ ਜੇ ਕੋਈ ਐ ਜਿਹੀ ਗੱਲ ਉਹਨੂੰ ਲੱਗੇ ਕਿ ਵੀ ਕੋਈ ਅਤੇ ਆਪ ਦੀ ਆਪ ਦੇ ਨਾਲ ਉਹ ਹੋਰ ਦੂਜਿਆਂ ਦੀ ਵੀ ਸੁਰੱਖਿਆ ਕਰ ਸਕੇ ਉਹ ਉਹਨਾਂ ਦਾ ਪਰਿਵਾਰ ਵੀ ਸੁਰੱਖਿਅਤ ਰਹੇ ਇਹ ਸ ਘਰ ਵਿੱਚ ਬੱਚਿਆਂ ਨੂੰ ਵੀ ਬੱਚਿਆਂ ਨੂੰ ਵੀ ਸੁਰੱਖਿਅਤ ਮਹਿਸੂਸ ਹੋਵੇ ਕਿ ਜੇ ਬਈ ਸਾਡੀ ਮੰਮੀ ਹੈਗੀ ਹੈ ਤਾਂ ਉਹ ਵੀ ਸਾਡੀ ਸੁਰੱਖਿਆ ਕਰ ਸਕਦੀ ਹੈਗੀ ਹੈ ਵੀ ਉਹ ਵੀ ਬੱਚਿਆਂ ਨੂੰ ਵੀ ਸ਼ਿਕਸ਼ਾ ਮਿਲੇਗੀ ਕਿ ਅਸੀਂ ਵੀ ਅੱਗੋਂ ਕਰਾਟੇ ਸਿੱਖੀਏ ਜੇ ਕੁੜੀਆਂ ਹੈਗੀਆਂ ਤਾਂ ਆਪਾਂ ਨੂੰ ਅੱਜ ਕੱਲ੍ਹ ਕੁੜੀਆਂ ਨੂੰ ਵੀ ਬਹੁਤ ਕੁੜੀਆਂ ਮੁੰਡਿਆਂ ਤੋਂ ਵੱਧ ਹੈਗੀਆਂ ਅਤੇ ਆਪਾ ਨੂੰ ਕੁੜੀਆਂ ਨੂੰ ਵੀ ਕਰਾਟੇ ਸਿਖਾਉਣੇ ਚਾਹੀਦੇ ਹੈ ਕਿ ਕੱਲ੍ਹ ਨੂੰ ਉਹ ਬਾਹਰ ਅੰਦਰ ਕਿਤੇ ਪੜ੍ਹਨ ਜਾਂਦੀਆਂ ਜਾਂ ਕਿਤੇ ਜਾਂਦੀਆਂ ਤਾਂ ਉਹਨਾਂ ਨੂੰ ਜੇ ਕੋਈ ਇਹੋ ਜਿਹਾ ਕੁਝ ਲੱਗੇ ਤਾਂ ਉਹ ਆਪਦੀ ਸੁਰੱਖਿਆ ਉਹ ਕਿਸੇ 'ਤੇ ਨਿਰਭਰ ਨਾ ਹੋਣ ਉਹ ਉਹ ਆਪ ਦੀ ਸੁਰੱਖਿਆ ਆਪ ਕਰ ਸਕਣ ਤਾਂ ਕਿ ਆਪਾਂ ਦੇਸ਼ ਸੁਰੱਖਿਅਤ ਸਮਾਜ ਬਣਾਉਣਾ ਆਪਾਂ ਵੀ ਕਿਸੇ ਦੀ ਹੋਰ ਦੀ ਆਪਾਂ ਨੂੰ ਹੋਰ 'ਤੇ ਆਪਾਂ ਨੂੰ ਡਿਪੈਂਡ ਨਹੀਂ ਹੋਣਾ ਚਾਹੀਦਾ